ਸੋਲ੍ਹਾਂ ਸਤੰਬਰ ਉੱਨੀ ਸੌ ਸਤੱਤਰ ਸੋਲ੍ਹਾਂ ਅਕਤੂਬਰ ਉੱਨੀ ਸੌ ਤਿਹੱਤਰ ਪੰਦਰ੍ਹਾਂ ਅਗਸਤ ਉੱਨੀ ਸੌ ਬਿਆਸੀ ਸਤਾਈ ਜੁਲਾਈ ਦੋ ਹਜ਼ਾਰ ਦੋ ਪੰਜ ਅਗਸਤ ਉੱਨੀ ਸੌ ਨੜਿਨਵੇਂ